ਪੰਜਾਬ ਵਿੱਚ ਪੰਜਾਬੀ ਗਾਇਕੀ ਤਾਂ ਬ ਮਸ਼ਹੂਰ ਮਸ਼ਹੂਰ ਤਾਂ ਹੈ ਹੀ ਹੈ ਪਰ ਇਸ ਤੋਂ ਇਲਾਵਾ ਜੋ ਸੂਫ਼ੀ ਅ ਗੀਤ ਹਨ ਉਹ ਵੀ ਬਹੁਤ ਮਹੱਤਵਪੂਰਨ ਪ੍ਰਭਾਵ ਪਾਉਂਦੇ ਹਨ ਆਪਣੇ ਪੰਜਾਬ ਅਤੇ ਪੰਜਾਬੀ ਗਾਇਕੀ 'ਤੇ ਇਹਨਾਂ ਵਿੱਚੋਂ ਮਤਲਬ ਬਹੁਤ ਹੀ ਜ਼ਿਆਦਾ ਸੂਫ਼ੀਵਾਦ ਸੌਂਗ ਅਤੇ ਪੰਜਾਬੀ ਸੌਂਗ ਮਸ਼ਹੂਰ ਹਨ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਆਤਿਫ ਅਸਲਮ ਦਾ ਸੌਂਗ ਜੋ ਹੈ ਅ ਤਸਦੀਰੇ ਹਾਰਮ ਔਰ ਸਾਦਗੀ ਸੌਗ ਤੁਮੇ ਦਿਲ ਲਗੀ ਭੂਲ ਜਾਣੀ ਪੜੇਗੀ ਜੋ ਕਿ ਨੁਸਰਤ ਫਤਿਹ ਅਲੀ ਖਾਨ ਹਲਕਾ ਹਲਕਾ ਸਰੂਰ ਜੋ ਹੈ ਇਹ ਨੁਸਰਤ ਫਤਿਹ ਅਲੀ ਖਾਨ ਜੀ ਦਾ ਹੈ ਔਰ ਜੋ ਉਹਨੂੰ ਆਪਾਂ ਕਹਿ ਸਕਦੇ ਹਾਂ ਜੇ ਤੂੰ ਇੱਕ ਉਹ ਹੈ ਨੁਸਰਤ ਫਤਹਿ ਅਲੀ ਖਾਨ ਜੀ ਦਾ ਜੇ ਤੂੰ ਰੱਬ ਨੂੰ ਮਨਾਉਣਾ ਇਹ ਮਤਲਬ ਬਹੁਤ ਹੀ ਮਸ਼ਹੂਰ ਸ ਸੰਗੀਤ ਹਨ ਹਾਂ ਔਰ ਆਪਾਂ ਕਿਆ ਕਹਿ ਸਕਦੇ ਹਾਂ ਕਿ ਇੱਕ ਇਹੋ ਜਿਹਾ ਸੂਫ਼ੀ ਸੰਗੀਤ ਜੋ ਮੇਰੇ ਦਿਲ ਨੂੰ ਭਾਉਂਦਾ ਹੈ ਉਹ ਹੈ ਜੇ ਤੂੰ ਰੱਬ ਨੂੰ ਮਨਾਉਣਾ ਅਤੇ ਇਹ ਮੇਰੇ ਲਈ ਮਤਲਬ ਸੂਫ਼ੀ ਸੰਗੀਤ ਵੀ ਮੇਰੇ 'ਤੇ ਬਹੁਤ ਅੱਛਾ ਪ੍ਰਭਾਵ ਪਾਉਂਦਾ ਹੈ